ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਿਹੜਾ ਰਜਨੀ ਬਾਲਾ ਹੈਗਾ ਅੱਜ ਮੈਂ ਤੁਹਾਨੂੰ ਜਿਹੜੀ ਆ ਟੈਕਨੋਲਜੀ ਦੇ ਬਾਰੇ ਜਿਹੜਾ ਅਸੀਂ ਕਹਿੰਨੇ ਆ ਅੱਜ ਕੱਲ ਜਿਹੜੀ ਨਵੀਂ ਟੈਕਨੋਲਜੀ ਜਿਹੜੀ ਆਈ ਹੈਗੀ ਆ ਉਹਦੇ ਸਾਨੂੰ ਹੋਰ ਸਾਰੇ ਲਾਭ ਹੁੰਦੇ ਹਨ ਜਿਹੜਾ ਸਭ ਤੋਂ ਪਹਿਲਾਂ ਹੁੰਦਾ ਸੀ ਲੋਕਾਂ ਕੋਲ ਫੋਨ ਨੀ ਹੁੰਦੇ ਸੀ ਉਹ ਫੋਨ ਜਿਹੜੇ ਹੁੰਦੇ ਬਟਨ ਵਾਲੇ ਹੁੰਦੇ ਸੀ ਅੱਜ ਕੱਲ ਜਿਹੜੇ ਆ ਫੋਨ ਮਤਲਵ ਫੋਨ ਜਿਹੜੇ ਆ ਫਿਰ ਇਸ ਤੋਂ ਬਾਅਦ ਕੀ ਹੋ ਗਿਆ ਜਿਹੜੇ ਫੋਨ ਜਿਹੜੇ ਸਾਡੇ ਕੋਲ ਟੱਚ ਵਾਲੇ ਫੋਨ ਲੱਗ ਪਏ ਪਰ ਹੌਲੀ ਹੌਲੀ ਜਿਹੜੇ ਨੈੱਟ ਸੀਗਾ ਉਹ ਥਰੀ ਜੀ ਫੌਰ ਜੀ ਫਾਈਵ ਜੀ ਹੋਣ ਲੱਗ ਪਿਆ ਉਹਦੇ ਨਾਲ ਜਿਹੜਾ ਹੈਗਾ ਸਾਨੂੰ ਅੱਜ ਕੱਲ ਦੇ ਬਹੁਤ ਸਾਰੇ ਲਾਭ ਨੇ ਲੋਕਾਂ ਨੂੰ ਜਿਹੜਾ ਅੱਜ ਕੱਲ ਦੀ ਤਕਰੀਬਨ ਕੰਮ ਜਿਹੜੇ ਹੁੰਦੇ ਆ ਅੱਜ ਕੱਲ ਉਹਦੇ ਤੇ ਮਤਲਬ ਫੋਨਾਂ ਤੇ ਹੀ ਹੁੰਦੇ ਹੈਗੇ ਐ ਨੈੱਟ ਤੋਂ ਹੀ ਮੈੱਟ ਰਾਹੀਂ ਕੰਮ ਕਰ ਸਕਦੇ ਹਨ ਜਿਹੜੇ ਲੋਕੀਂ ਬਾਹਰ ਮਤਲਵ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੁੰਦੇ ਹਨ ਉਹਨਾਂ ਦਾ ਅਸੀਂ ਮਤਲਬ ਬੜੀ ਆਸਾਨੀ ਨਾਲ ਗੱਲ ਕਰ ਲੈਂਦੇ ਅੱਜ ਕੱਲ ਜਿਹੜੀ ਵੀਡੀਓ ਕਾਲਿੰਗ ਹੈਗੀ ਆ ਜਿਹੜੇ ਬੱਚੇ ਜਿਹੜੇ ਬਾਹਰ ਜਾਂਦੇ ਹਨ ਉਹਨਾਂ ਨੂੰ ਅਸੀਂ ਮਤਲਬ ਆਰਾਮ ਨਾਲ ਕਰ ਸਕਦੇ ਹਨ ਪਹਿਲਾਂ ਉਹਨਾਂ ਦੀ ਗੱਲ ਸੁਣ ਵੀ ਸਕਦੇ ਹਨ ਉਹਨਾਂ ਨੂੰ ਦੇਖ ਵੀ ਸਕਦੇ ਹਨ ਤੇ ਸਾਨੂੰ ਜਿਹੜੀ ਆ ਟੈਕਨੋਲੋਜੀ ਨੇ ਬਹੁਤ ਸਾਰੇ ਲਾਭ ਹਨ ਅਤੇ ਬਹੁਤ ਸਾਰੀ ਨੋਲਿਜ ਵੀ ਮਿਲਦੀ ਹੈਗੀ ਆ ਅੱਜ ਸਾਨੂੰ ਜਦੋਂ ਕੋਈ ਵੀ ਕੋਈ ਪ੍ਰੋਜੈਕਟ ਤੇ ਕੰਮ ਕਰਨਾ ਹੋਵੇ ਕੋਈ ਵੀ ਪੇਂਟਿੰਗ ਦਾ ਕੰਮ ਕਰਨਾ ਹੋਏ ਕੋਈ ਵੀ ਕੰਮ ਕਰਨਾ ਹੋਏ ਸਾਨੂੰ ਕੋਈ ਸੋਫਟਵੇਅਰ 'ਤੇ ਕੰਮ ਕਰਨਾ ਹੋਏ ਅਸੀਂ ਨੈੱਟ ਦੇ ਉਪਯੋਗ ਕਰਦੇ ਹਨ ਨੈੱਟ ਜਿਹੜਾ ਹੈ ਉਹਦੇ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਕਿਉਂਕਿ ਇਹਦੇ ਨਾਲ ਜਿਹੜਾ ਮਤਲਬ ਇੱਕ ਬੰਦੇ ਦਾ ਕੰਮ ਜਿਹੜਾ ਬਹੁਤ ਹੀ ਮਤਲਬ ਆਸਾਨ ਕਰ ਦਿੱਤਾ ਟੈਕਨੋਲੋਜੀ ਦੇ ਜਮਾਨੇ ਚ ਲੋਕਾਂ ਨੂੰ ਮਤਲਬ ਪਹਿਲੇ ਟਾਈਮ ਦੇ ਲੋਕਾਂ ਨੂੰ ਮਤਲਬ ਬਹੁਤ ਕੰਮ ਕਰਦੇ ਬਹੁਤ ਮੁਸ਼ਕਿਲ ਹੁੰਦੀ ਸੀ ਹੁਣ ਲੋਕੀ ਜਿਹੜੇ ਆ ਆਰਾਮ ਨਾਲ ਆਪਣਾ ਕੰਮ ਟੈਕਨੋਲੋਜੀ ਰਾਹੀਂ ਆਪਣਾ ਇੰਟਰਨੈਟ ਰਾਹੀਂ ਆਪਣਾ ਕੰਮ ਜਿਹੜਾ ਬੜੇ ਆਰਾਮ ਨਾਲ ਕਰ ਲੈਂਦੇ ਹਨ ਕੋਈ ਪ੍ਰੋਜੈਕਟ ਜਿਹੜਾ ਕਰਨਾ ਅਸੀਂ ਮਤਲਬ ਬੜਾ ਜਲਦੀ ਸਾਨੂੰ ਆਸਾਨੀ ਨਾਲ ਹੋ ਜਾਂਦਾ ਕਿਸ ਕਈ ਵਾਰੀ ਹੁੰਦਾ ਸਾਨੂੰ ਕਿਸੀ ਚੀਜ਼ ਦੀ ਨੌਲੇਜ ਨੀ ਹੁੰਦੀ ਅਸੀਂ ਨੈੱਟ ਤੋਂ ਹੀ ਇਹਨੂੰ ਸਰਚ ਕਰਦੇ ਹਾਂ ਤੇ ਸਾਨੂੰ ਤਾਂ ਸਾਨੂੰ ਸਾਰਾ ਪਤਾ ਲੱਗ ਜਾਂਦਾ ਕੀ ਇਹ ਮਤਲਬ ਇਹ ਕੰਮ ਅਸੀਂ ਕਿਸ ਤਰਾਂ ਕਰ ਸਕਦੇ ਹਨ ਧੰਨਵਾਦ